ਹੈਲੋ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਸਾਰੇ ਤਰ੍ਹਾਂ ਦੇ ਹੀ ਬਣਾਉਂਦੇ ਹਾਂ ਅਸੀਂ ਤਾਂ ਚੋਕਲੇਟ ਵਾਲਾ ਵੀ ਹਾਂਜੀ ਵਧੀਆ ਵਧੀਆ ਅਸੀਂ ਤਾਂ ਬਹੁਤ ਬਣਾਉਂਦੇ ਹਾਂ ਰੇਟ ਰੇਟ ਹੈਗਾ ਛੇ ਸੌ ਰੁਪਇਆ ਕਿਲੋ ਦਾ ਹਾਂਜੀ ਅਤੇ ਜੇ ਲੈਣਾ ਦੋ ਕਿਲੋ ਦਾ ਫਿਰ ਹਜ਼ਾਰ ਰੁਪਇਆ ਹਾਂਜੀ ਅਸੀਂ ਕਾਫੀ ਕੁਛ ਹੀ ਬਣਾਉਂਦੇ ਹਾਂ ਸਾਡੇ ਬਹੁਤ ਚੀਜ਼ਾਂ ਬਣਦੀਆਂ ਤੁਸੀਂ ਆ ਜਾਇਓ ਅਤੇ ਵੇਖ ਜਾਇਓ ਜਿਹੜਾ ਕੋਈ ਤੁਹਾਨੂੰ ਚਾਹੀਦਾ ਉਹੀ ਤੁਸੀਂ ਲਿਜਾ ਸਕਦੇ ਆ ਅਤੇ ਵੀ ਆਏਂ ਕੇਕ ਤਾਂ ਅਸੀਂ ਪੰਦਰਾਂ ਪੰਦਰਾਂ ਵੀ ਬਣਾ ਲੈਂਦੇ ਹਾਂ ਵੀਹ ਵੀਹ ਬਣ ਜਾਂਦੇ ਆ ਵੀ ਮੰਨ ਲਓ ਕੇਕ ਸਾਡੇ ਬਹੁਤ ਬਣਦੇ ਆ ਹਾਂਜੀ ਜੀ ਜਿਹੋ ਜਿਹਾ ਕਹੋਗੇ ਉਹੋ ਜਿਹਾ ਕਰ ਦਵਾਂਗੇ ਬਹੁਤ ਵਧੀਆ ਹੀ ਕਰਦੇ ਹਾਂ ਅਜੇ ਤੱਕ ਹਰ ਇੱਕ ਦੇ ਇਹੀ ਪਸੰਦ ਆਉਂਦਾ ਸਾਡਾ ਕੇਕ ਕੋਈ ਕਿਸੇ ਨੇ ਕਦੇ ਅਜੇ ਤੱਕ ਨਿੰਦਿਆ ਨਹੀਂ ਬਹੁਤ ਸੋਹਣਾ ਹੀ ਬਣਦਾ ਹੈ ਜਿਹੜਾ ਤੁਸੀਂ ਭਾਵੇ ਚੋਕਲੇਟ ਵਾਲਾ ਬਣਵਾ ਲਿਓ ਅਤੇ ਜਾਂ ਤੁਸੀਂ ਦੱਸ ਦਓ ਵੀ ਕਿਹੜੇ ਤਰ੍ਹਾਂ ਦਾ ਬਣਾਉਣਾ ਹੈ ਆਪਾਂ ਉਸੇ ਤਰ੍ਹਾਂ ਦਾ ਹੀ ਬਣਾ ਦਵਾਂਗੇ ਪੰਜ ਕਿਲੋ ਦਾ ਤਾਂ ਫਿਰ ਆਪਾਂ ਮਹਿੰਗਾ ਹੀ ਬਣੂਗਾ ਦੋ ਕਿਲੋ ਦਾ ਹੀ ਲੱਗ ਜਾਣਾ ਹਜ਼ਾਰ ਰੁਪਇਆ ਤਾਂ ਬਣ ਹੀ ਜਾਊਗਾ ਪੱਚੀ ਕੁ ਸੌ ਦਾ ਲੈੱਸ ਕੋਈ ਥੋੜ੍ਹੀ ਬਹੁਤੀ ਹੋ ਜਾਊਗੀ ਬਹੁਤੀ ਤਾਂ ਨਹੀਂ ਹੁੰਦੀ ਅਸੀਂ ਫਿਰ ਵਧੀਆ ਕੁਆਲਿਟੀ ਦਾ ਜੋ ਬਣਾਉਂਦੇ ਹਾਂ ਤਾਜ਼ਾ ਹੀ ਤਾਜ਼ਾ ਹੀ ਤਾਜ਼ਾ ਹੀ ਬਣਦੇ ਹੈ ਇੱਥੇ ਰੋਜ਼ ਦੇ ਰੋਜ਼ ਦੇ ਹੀ ਵਿਕ ਜਾਂਦੇ ਆ ਵਧੀਆ ਵਧੀਆ ਕ੍ਰੀਮ ਲਾਉਂਦੇ ਹਾਂ ਤਾਜ਼ੀ

ਹਾਂਜੀ ਹਾਂਜੀ ਨਹੀਂ ਜੀ ਨਹੀਂ ਵਧੀਆ ਬਣਾਵਾਂਗੇ ਹਾਂਜੀ ਹਾਂਜੀ ਹਾਂਜੀ ਠੀਕ ਆ ਜੀ ਚੋਕਲੇਟ ਵਾਲਾ ਤਿਆਰ ਕਰਦਾਂਗੇ ਅਤੇ ਬਹੁਤ ਵਧੀਆ ਬਣੇਗਾ ਨਹੀਂ ਨਹੀਂ ਕੇਕ ਬਹੁਤ ਵਧੀਆ ਤਿਆਰ ਹੋਊਗਾ ਅਤੇ ਆਪਾਂ ਵੀ ਹਜ਼ਾਰ ਰੁਪਏ ਤੱਕ ਤੁਹਾਨੂੰ ਵੀ ਲਾ ਲਵਾਂਗੇ ਅਤੇ ਤੁਸੀਂ ਤਿਆਰ ਕਰਵਾ ਲਿਓ ਠੀਕ ਆ ਹਾਂਜੀ ਚਲੋ ਠੀਕ ਆ ਜੀ ਅਤੇ ਨਾਮ ਲਿਖਾ ਦਓ ਆਪਦਾ ਚਲੋ ਠੀਕ ਆ